ਯੋਗਾ ਕਰਨਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਯੋਗੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਗਾ ਮੈਂ ਅਕਸਰ ਹੀ ਟੀਵੀ ਦੇ ਉੱਤੇ ਦੇਖਦੀ ਹੁੰਦੀ ਸੀ ਕਿ ਯੋਗਾ ਕਰਨ ਨਾਲ ਸਾਡੇ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਮੋਟਾਪਾ ਨਹੀਂ ਆਉਂਦਾ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਯੋਗਾ ਕਰਨ ਨਾਲ ਅਤੇ ਫਿਰ ਟੀਵੀ ਦੇਖ ਕੇ ਮੈਂ ਹੌਲੀ ਹੌਲੀ ਯੋਗਾ ਕਰਨਾ ਸ਼ੁਰੂ ਕੀਤਾ ਅਤੇ ਯੋਗਾ ਜਦੋਂ ਮੈਂ ਸ਼ੁਰੂ ਕਰਨਾ ਸ਼ੁਰੂ ਕੀਤਾ ਤਾਂ ਮੇਰਾ ਸਰੀਰ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲੀ ਕਿਉਂਕਿ ਯੋਗੇ ਦੇ ਬਹੁਤ ਸਾਰੇ ਲਾਭ ਹੁੰਦੇ ਹਨ ਇਹਨੇ ਸਾਡੇ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਕੀਤਾ ਮਾਸਪੇਸ਼ੀਆਂ ਲਚਕਤਾ ਵਿੱਚ ਸੁਧਾਰ ਆਉਂਦਾ ਪਾਚਨ ਤੰਤਰ ਨੂੰ ਚੰਗਾ ਬਣਾਉਂਦਾ ਯੋਗਾ ਅੰਦਰੂਨਦੀ ਅੰਗਾਂ ਨੂੰ ਮਜ਼ਬੂਤ ਕਰਦਾ ਦਮੇ ਦਾ ਇਲਾਜ ਕਰਦਾ ਯੋਗੇ ਨਾਲ ਸ਼ੁਗਰ ਦੀ ਬਿਮਾਰੀ ਵੀ ਠੀਕ ਹੁੰਦੀ ਆ ਇਹਨਾਂ ਸੰਬੰਧਿਤ ਕਈ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਯੋਗਾ ਕਰਨ ਨਾਲ ਮੇਰਾ ਸਰੀਰ ਠੀਕ ਰਹਿਣ ਲੱਗ ਗਿਆ ਮੇਰੇ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗੀ ਇਸ ਲਈ ਯੋਗਾ ਕਰਨਾ ਬਹੁਤ ਜ਼ਰੂਰੀ ਆ ਸਾਰਿਆਂ ਨੂੰ ਅਤੇ ਮੈਨੂੰ ਮੈਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਜੋ ਵੀ ਠੀਕ ਹੋਗੀ ਯੋਗਾ ਕਰਨ ਨਾਲ ਯੋਗਾ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਇਸ ਨੂੰ ਇਹ ਲੋਕਾਂ ਜਦ ਅਸੀਂ ਯੋਗਾ ਕਰਦੇ ਹਾਂ ਸਾਡਾ ਸਰੀਰ ਪੂਰਾ ਤੰਦਰੁਸਤ ਰਹਿੰਦਾ ਸਾਡੇ ਸਰੀਰ ਵਿੱਚ ਪੂਰੀ ਐਨਰਜੀ ਰਹਿੰਦੀ ਆ ਯੋਗਾ ਕਰਨ ਨਾਲ ਇਸ ਲਈ ਸਾਨੂੰ ਰੋਜ਼ ਯੋਗਾ ਕਰਨਾ ਚਾਹੀਦਾ ਜੋ ਸਾਡੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਵ ਲਿਆਉਂਦਾ ਗਾ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਸੀਂ ਕੰਮ ਪੂਰਾ ਵਧੀਆ ਤਰੀਕੇ ਨਾਲ ਕਰਦੇ ਹਾਂ